ਮੈਨੂੰ ਬਾਈਕਿੰਗ ਸਟਾਰਟ ਕਰਨ ਲਈ ਪ੍ਰੇਰਿਤ ਕੀਤਾ ਮੇਰੇ ਪਿਤਾ ਜੀ ਨੇ ਉਹਨਾਂ ਨੇ ਕਿਹਾ ਕਿ ਆਪਣਾ ਅਗਰ ਤੁਹਾਨੂੰ ਤੁਸੀਂ ਸਕੂਟਰੀ ਜਾਂ ਬਾਈਕ ਚਲਾ ਸਕਦੇ ਹੋ ਤਾਂ ਤੁਸੀਂ ਆਪਣਾ ਕੋਈ ਵੀ ਕੰਮ ਹੈ ਖੁਦ ਜਿਹੜਾ ਹੈ ਤੁਹਾਨੂੰ ਕਿਸੇ 'ਤੇ ਡਿਪੈਂਡ ਨਹੀਂ ਰਹਿਣਾ ਪਵੇਗਾ ਤੁਸੀਂ ਖੁਦ ਆਪਣਾ ਕੰਮ ਜਾ ਕੇ ਕਦੇ ਵੀ ਕੰਪਲੀਟ ਕਰ ਸਕਦੇ ਹੋ ਪੂਰਾ ਕਰ ਸਕਦੇ ਹੋ ਤੁਹਾਡਾ ਕੋਈ ਵੀ ਨਿੱਕਾ ਵ ਕੰਮ ਹੈ ਤੁਹਾਡਾ ਕੋਈ ਵੀ ਵੱਡਾ ਕੰਮ ਹੈ ਤਾਂ ਤੁਸੀਂ ਅਗਰ ਤੁਹਾਨੂੰ ਬਾਈਕ ਚਲਾਉਣੀ ਆਉਂਦੀ ਹੈ ਜਾਂ ਸਕੂਟੀ ਚਲਾਉਣੀ ਆਉਂਦੀ ਹੈ ਤਾਂ ਤੁਸੀਂ ਉਸ ਕੰਮ ਨੂੰ ਆਪਣੇ ਆਪ ਤੋਂ ਜਾ ਕੇ ਕਿਸੇ ਦੀ ਲੋੜ ਲਏ ਬਿਨਾਂ ਤੁਸੀਂ ਉਸ ਆਪਣੇ ਕੰਮ ਨੂੰ ਪੂਰਾ ਕਰ ਸਕਦੇ ਹੋ ਜਾ ਕੇ ਕਿਤੇ ਵੀ ਕਿਸੇ ਵੀ ਆਫਿਸ 'ਚ ਜਾਣਾ ਹੈ ਕਿਸੇ ਦਫ਼ਤਰ 'ਚ ਜਾ ਕੇ ਤੁਸੀਂ ਆਪਣਾ ਕੰਮ ਕਰਵਾਉਣਾ ਹੈ ਤਾਂ ਤੁਸੀਂ ਕਿਸੇ ਵੀ ਟਾਈਮ ਆਪਣੀ ਸਕੂਟਰੀ ਚੁੱਕ ਕੇ ਜਾਂ ਆਪਣੀ ਬਾਈਕ ਨੂੰ ਲੈ ਕੇ ਨਾਲ ਤੁਸੀਂ ਉਸ ਕੰਮ ਨੂੰ ਕਰ ਸਕਦੇ ਹੋ ਇਸ ਚੀਜ਼ ਦੀ ਜਿਹੜੀ ਸ਼ਿਕਸ਼ਾ ਹੈ ਸਿੱਖਿਆ ਹੈ ਮੈਨੂੰ ਮੇਰੇ ਪਿਤਾ ਜੀ ਤੋਂ ਮਿਲੀ ਹੈ ਬਾਕੀ ਜਦੋਂ ਮੈਨੂੰ ਸ ਬਾਈਕਿੰਗ ਚਲਾਉਣੀ ਸ਼ੁਰੂ ਕੀਤੀ ਮੈਂ ਬਾਈਕਿੰਗ ਕਰਨੀ ਸ਼ੁਰੂ ਕੀਤੀ ਸਕੂਟੀ ਚਲਾਉਣੀ ਸਟਾਰਟ ਕੀਤੀ ਤਾਂ ਜਿਵੇਂ ਜਿਵੇਂ ਮੈਂ ਇਹ ਚਲਾਉਂਦੀ ਰਹੀ ਕਰਦੀ ਰਹੀ ਟਾਈਮ ਬੀਤਦਾ ਗਿਆ ਤਾਂ ਉਸ ਤੋਂ ਬਾਅਦ ਮੈਨੂੰ ਇਸ ਚੀਜ਼ ਦੀ ਆਦਤ ਹੁੰਦੀ ਗਈ ਕਿਉਂਕਿ ਇਸ ਚੀਜ਼ ਨਾਲ ਮੇਰਾ ਕੰਮ ਜਿਹੜਾ ਆ ਸੌਖਾ ਹੋ ਜਾਂਦਾ ਸੀਗਾ ਮੈਨੂੰ ਕਿਸੇ 'ਤੇ ਡਿਪੈਂਡ ਨਹੀਂ ਰਹਿਣਾ ਪੈਂਦਾ ਸੀ ਮੈਂ ਖੁਦ ਜਿੱਥੇ ਵੀ ਮਰਜ਼ੀ ਜਾ ਸਕਦੀ ਹਾਂ ਕਦੇ ਵੀ ਜਾ ਸਕਦੀ ਹਾਂ ਆਪਣਾ ਕੰਮ ਕਰ ਸਕਦੀ ਹਾਂ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਸਾਲ ਲੰਘਦੇ ਗਏ ਤਾਂ ਇਸ ਚੀਜ਼ ਦੀ ਮੈਨੂੰ ਹੁਣ ਆਦਤ ਪੈ ਗਈ ਹੈ ਹੁਣ ਇੱਕ ਤਰ੍ਹਾਂ ਦਾ ਜਨੂੰਨ ਮੇਰੇ ਸਿਰ 'ਤੇ ਸਵਾਰ ਹੋ ਗਿਆ ਹੈ ਕਿ ਮੈਂ ਕੋਈ ਵੀ ਕੰਮ ਕਰਨਾ ਆ ਆਪਣਾ ਤਾਂ ਮੈਂ ਖੁਦ ਕਰਨਾ ਹੈ ਜਾ ਕੇ ਜਾਂ ਮੈਂ ਆਪਣੀ ਸਕੂਟੀ ਜਾਊਂਗੀ ਅਤੇ ਆਪਣਾ ਕੰਮ ਕਰਕੇ ਆਰਾਮ ਨਾਲ ਵਾਪਿਸ ਆ ਜਾਊਂਗੀ ਮੈਨੂੰ ਕਿਸੇ ਨੂੰ ਨਾਲ ਲੈ ਕੇ ਜਾਣ ਦੀ ਵੀ ਜ਼ਰੂਰਤ ਲੋੜ ਮਹਿਸੂਸ ਨਹੀਂ ਹੁੰਦੀ ਤਾਂ ਇਹ ਹੁਣ ਇੱਕ ਤਰ੍ਹਾਂ ਦਾ ਜਨੂੰਨ ਬਣ ਚੁੱਕਿਆ ਹੈ ਬਾਈਕਿੰਗ ਮੇਰੇ ਲਈ ਬਸ ਮੈਂ ਇੰਨਾ ਹੀ ਕਹਿਣਾ ਚਾਹੂੰਗੀ ਕਿ ਤੁਹਾਡੇ ਲਈ ਜਾਂ ਹਰ ਕਿਸੇ ਲਈ ਤੁਹਾਨੂੰ ਸਕੂਟਰੀ ਜਾਂ ਬਾਈਕ ਚਲਾਉਣੀ ਆਉਣੀ ਜ਼ਰੂਰੀ ਹੈ ਡਰਾਈਵਿੰਗ ਸਿੱਖਣਾ ਤੁਹਾਡੇ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਹੈ ਸਾਡੇ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਹੈ ਇਹ ਇਹਨੂੰ ਸਿੱਖਣ ਦਾ ਹਰ ਕਿਸੇ ਦੇ ਵਿੱਚ ਇੱਕ ਤਰ੍ਹਾਂ ਦਾ ਜਨੂੰ ਜਨੂੰਨ ਹੋਣਾ ਹੀ ਚਾਹੀਦਾ ਹੈ